ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀ ਦੇ ਬਹੁਤ ਹੀ ਫਾਇਦੇ ਹਨ ਇਹ ਸਾਡੇ ਫੇਫੜਿਆਂ ਦੇ ਵਿੱਚ ਸਾਹ ਲੈਣ ਦੇ ਵਿੱਚ ਬਹੁਤ ਮਦਦ ਕਰਦੀ ਹੈ ਜਦੋਂ ਅਸੀਂ ਆਪਣੇ ਸਾਹ ਨੂੰ ਰੋਕ ਰੋਕ ਕੇ ਲੰਬੇ ਲੰਬੇ ਸਾਹ ਲੈ ਲੈ ਕੇ ਤੈਰਾਕੀ ਕਰਦੇ ਹਾਂ ਤਾਂ ਸਾਡੇ ਫੇਫੜਿਆਂ ਦੀ ਐਕਸਰਸਾਈਜ਼ ਹੁੰਦੀ ਹੈ ਸਾਡੇ ਫੇਫੜਿਆਂ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਆਕਸੀਜਨ ਭਰਨ ਦੀ ਸਮਰੱਥਾ ਵੱਧਦੀ ਹੈ ਜਿਹਦੇ ਨਾਲ ਸਾਨੂੰ ਕਿ ਸਾਡੀ ਸਾਹ ਦੇ ਜੋ ਰੋਗ ਨੇ ਉਹ ਘੱਟ ਜਾਂਦੇ ਹਨ ਸਾਨੂੰ ਡਾਕਟਰਾਂ ਦੇ ਪਿੱਛੇ ਜ਼ਿਆਦਾ ਭੱਜਣਾ ਨਹੀ ਫਿਰਨਾ ਚਾਹੀਦਾ ਦਮੇ ਦੇ ਰੋਗ ਵੀ ਘੱਟਦੇ ਹਨ ਦੂਸਰਾ ਜਦੋਂ ਅਸੀਂ ਤ ਤੈਰਾਕੀ ਕਰਦੇ ਹਾਂ ਤਾਂ ਇਹਦੇ ਨਾਲ ਜੋ ਸਾਡਾ ਸਰੀਰ ਹੈ ਤੰਦਰੁਸਤ ਅਰੋਗ ਅਤੇ ਖੂਬਸੂਰਤ ਬਣਦਾ ਹੈ ਅਤੇ ਅਸੀਂ ਇੱਕ ਬਹੁਤ ਹੀ ਪਰਸਨਲਟੀ ਜਾਂ ਪਰਸਨਲਟੀ ਦੇ ਮਾਲਕ ਬਣ ਜਾਂਦੇ ਹਾਂ ਸਾਡੇ ਜਦੋਂ ਅਸੀਂ ਤੈਰਾਕੀ ਕਰਦੇ ਹਾਂ ਹੱਥਾਂ ਅਤੇ ਪੈਰਾਂ ਦੀ ਵਰਜਿਸ਼ ਹੁੰਦੀ ਹੈ ਇਸ ਦੇ ਨਾਲ ਹੀ ਜੋ ਸਾਡਾ ਪੇਟ ਹੈ ਉਹ ਵੀ ਨਹੀਂ ਵੱਧਦਾ ਸਾਡਾ ਭਾਰ ਵੀ ਕਾਫੀ ਘਟਾਉਣ ਦੇ ਵਿੱਚ ਜ ਜੋ ਤੈਰਾਕੀ ਹੈ ਉਹ ਸਾਡੀ ਮਦਦ ਕਰਦੀ ਹੈ ਇਸ ਤੋਂ ਇਲਾਵਾ ਤੈਰਾਕੀ ਸਮੁੱਚੀ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੈ